ਹੈਲੋ ਹਾਂਜੀ ਕੌਣ ਸਤਿ ਸ਼੍ਰੀ ਅਕਾਲ ਸਰ ਅੱਛਾ ਜੀ ਸਰ ਇੱਥੇ ਬਠਿੰਡਾ ਸਿਟੀ ਘੁੰਮਣਾ ਹਾਂਜੀ ਬਠਿੰਡਾ ਸਿਟੀ ਆਪਣੇ ਨਾ ਬਰਨਾਲਾ ਰੋਡ 'ਤੇ ਇੱਕ ਰੋਜ਼ ਗਾਰਡਨ ਆ ਜੀ ਤੁਸੀਂ ਇਹ ਘੁੰਮ ਸਕਦੇ ਆ ਬਹੁਤ ਵਧੀਆ ਰੋਜ ਗਾਰਡਨ ਆ ਹਾਂਜੀ ਠੀਕ ਹੈ ਜੀ ਸਰ ਸਟੇਸ਼ਨ ਤੋਂ ਸਿਰਫ਼ ਵੀਹ ਕੁ ਮਿੰਟ ਦਾ ਰਸਤਾ ਹੈ ਅਤੇ ਹਾਂਜੀ ਬਸ ਹਾਂਜੀ ਆਟੋ ਕੈਬ ਸਾਰਾ ਕੁਛ ਮਿਲੇਗਾ ਬਸ ਪੰਦਰਾਂ ਆਪਣੇ ਜੀ ਜ਼ਿਆਦਾ ਕਿਰਾਇਆ ਵੀ ਨਹੀਂ ਪਚਾਸ ਰੁਪਏ ਵਗੈਰਾ ਕਿਰਾਇਆ ਵਾ ਜੀ ਹਾਂਜੀ ਔਰ ਹਾਂਜੀ ਹੇ ਹਾਂਜੀ ਰੋਜ ਗਾਰਡਨ ਦੇ ਬਿਲਕੁਲ ਨੇੜੇ ਹੀ ਹੈਗਾ ਆਪਣਾ ਮੋਲ ਆ ਮਿੱਤਲ ਮੋਲ ਬਹੁਤ ਵਧੀਆ ਉਹ ਠੀਕ ਹਾਂਜੀ ਸਰ ਕੋਈ ਨਹੀਂ ਹੈ ਦਸ ਕੁ ਮਿੰਟ ਦਾ ਰਸਤਾ ਹੀ ਹੈ ਸਿਰਫ਼ ਪੈਦਲ ਵੀ ਜਾ ਸਕਦੇ ਆ ਔਰ ਕੋਈ ਆਟੋ ਵਗੈਰਾ ਤੋ ਅ ਉਹ ਤੁਹਾਡੀ ਮਰਜ਼ੀ ਆ ਨਾ ਠੀਕ ਹੈ ਜੀ ਓਕੇ ਓਕੇ ਜੀ